ਸਾਡੇ ਧਾਰਮਿਕ ਤਿਉਹਾਰਾਂ ਨਾਲ ਸੰਬੰਧਿਤ ਖਾਣ ਪੀਣ ਦੀਆਂ ਚੀਜ਼ਾਂ ਵੱਖ ਵੱਖ ਹਨ ਆਮ ਤੌਰ 'ਤੇ ਹਰ ਰੋਜ਼ ਦੀ ਜ਼ਿੰਦਗੀ ਵਿੱਚ ਅਸੀਂ ਘਰਾਂ ਵਿੱਚ ਹੀ ਅਤੇ ਗੁਰਦੁਆਰਿਆਂ ਵਿੱਚ ਵੀ ਸਾਦਾ ਖਾਣਾ ਹੀ ਖਾਂਦੇ ਹਾਂ ਜਿਵੇਂ ਰੋਟੀ ਦਾਲ ਚਾਵਲ ਸਬਜ਼ੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਬਦਲ ਬਦਲ ਕੇ ਸਬਜ਼ੀਆਂ ਮਿੱਠੇ ਦੇ ਵਿੱਚ ਕੜਾਹ ਖੀਰ ਹੋਰ ਤ ਆਦਿ ਇੱਕ ਤਰ੍ਹਾਂ ਦੇ ਤਿਉਹਾਰਾਂ ਦੇ ਵਿੱਚ ਕਈ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਜੋਤੀ ਜੋਤ ਦਿਵਸ ਫਤਿਹ ਦਿਵਸ ਗੁਰਗੱਦੀ ਦਿਵਸ ਇਹਨਾਂ ਦਿਨਾਂ ਵਿੱਚ ਖਾਸ ਤੌਰ 'ਤੇ ਕਈ ਪਕਵਾਨ ਬਣਾਏ ਜਾਂਦੇ ਹਨ ਜਿਵੇਂ ਕਿ ਜਲੇਬੀਆਂ ਪਕੌੜੇ ਫਲ ਫਰੂਟ ਕੱਟ ਕੇ ਇਕੱਠਾ ਕਰਕੇ ਅਤੇ ਕੇਕ ਪੇਸਟੀਆਂ ਵੀ ਵਰਤਾਉਣ ਲੱਗ ਜ ਗਏ ਹਨ ਅੱਜ ਦੇ ਸਮੇਂ ਵਿੱਚ ਬੱਚੇ ਪੀਜ਼ਾ ਬਰਗਰ ਨਿਊਡਲ ਅਤੇ ਚਾਂਪ ਖਾ ਕੇ ਵੀ ਖੁਸ਼ ਹਨ ਅਤੇ ਉਸਦੇ ਵੀ ਲੰਗਰ ਲਗਾਉਣੇ ਸ਼ੁਰੂ ਹੋ ਗਏ ਹਨ ਡੋਸਾ ਇਡਲੀ ਸਾਂਬਰ ਵੜਾ ਸਾਂਬਰ ਭਾਜੀ ਵੀ ਲੰਗਰ ਵਿੱਚ ਤਿਆਰ ਹੋਣੀ ਸ਼ੁਰੂ ਹੋ ਚੁੱਕੀ ਹੈ ਟਿੱਕੀ ਵੀ ਜੂਸ ਵੀ ਬਦਾਮਾਂ ਵਾਲਾ ਦੁੱਧ ਵੀ ਦੁਸਹਿਰੇ ਨੂੰ ਦੁਸਹਿਰਾ ਸਾਡੇ ਪੰਜਾਬ ਵਿੱਚ ਪ੍ਰਸਿੱਧ ਤਿਉਹਾਰ ਮਨਾਇਆ ਜਾਂਦਾ ਹੈ ਦੁਸਹਿਰੇ ਨੂੰ ਗੰਨਾ ਸਭ ਤੋਂ ਵੱਧ ਖਰੀਦਣ ਅਤੇ ਚੂਪਦੇ ਹਨ ਲੋਕ ਜਲੇਬੀਆਂ ਵੀ ਖਾਂਦੇ ਹਨ ਅਤੇ ਜਲੇਬੀਆਂ ਦਾ ਉਤਸ਼ਾਹ ਸਾਰੇ ਪੰਜਾਬ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਵਿਸਾਖੀ ਨੂੰ ਲੋਕ ਜਲੇਬੀਆਂ ਇੱਕ ਦੂਜੇ ਨੂੰ ਵੰਡਦੇ ਹਨ ਅਤੇ ਖਾਂਦੇ ਹਨ ਬਦਾਮਾਂ ਵਾਲਾ ਦੁੱਧ ਕਾੜ ਕੇ ਕੇਸਰ ਪਾ ਕੇ ਦੁੱਧ ਵਰਤਾਇਆ ਜਾਂਦਾ ਹੈ ਦਿਵਾਲੀ ਦੇ ਕਈ ਘਰ ਵਿੱਚ ਕਈ ਆਪਣੇ ਵਰਕਰਾਂ ਨੂੰ ਮਠਿਆਈ ਦਿੱਤੀ ਜਾਂਦੀ ਹੈ ਬਹੁਤ ਤਰ੍ਹਾਂ ਦੀਆਂ ਮਠਿਆਈਆਂ ਪਿੰਨੀਆਂ ਪਤੀਸੇ ਕਾਜੂ ਪਿਸਤਾ ਬਦਾਮ ਮਿਲਕ ਕੇਕ ਆਦਿ ਦੇ ਡੱਬੇ ਇੱਕ ਦੂਜੇ ਨੂੰ ਉਪ ਉਪਹਾਰ ਦੇ ਤੌਰ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਦਿੱਤੇ ਜਾਂਦੇ ਹਨ ਇਸ ਦਿਵਾਲੀ ਦੇ ਤਿਉਹਾਰ ਵਿੱਚ ਸਫ਼ਾਈ ਦੇ ਨਾਲ ਨਾਲ ਲੋਕ ਇੱਕ ਦੂਜੇ ਨੂੰ ਗਿਫਟ ਵੀ ਦਿੰਦੇ ਹਨ ਸਭਿਆਚਾਰਕ ਕਿਸੇ ਖਾਸ ਧਰਮ ਦੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ ਸੱਭਿਆਚਾਰਕ ਨਿਸ਼ਚੇ ਉਸ ਧਰਮ ਦੇ ਜੀਵਨ ਨਾਲ ਜੁੜੇ ਵੱਖ ਵੱਖ ਵਿਚਾਰਾਂ ਰਹਿਣ ਸਹਿਣ ਕਦਰਾਂ ਕੀਮਤਾਂ ਖਾਣ ਪੀਣ ਰੀਤੀ ਰਿਵਾਜਾਂ ਅਤੇ ਪਹਿਰਾਵੀ ਬੋਲੀ ਅਤੇ ਤੀਜ਼ ਤਿਉਹਾਰ ਦਾ ਸੁਮੇਲ ਹੈ ਕਿਸੇ ਰਿਵਾਇਤੀ ਪਕਵਾਨ ਹਨ ਸਾਡੇ ਪੰਜਾਬ ਦੇ ਜਿਵੇਂ ਦਾਲ ਕੜਾਹ ਖੀਰ ਸਾਗ ਮੱਕੀ ਦੀ ਰੋਟੀ ਆਲੂ ਦਾ ਕੁਲਚਾ ਸਾਗ ਅੰਮ੍ਰਿਤਸਰ ਵਿੱਚ ਬਹੁਤ ਹੀ ਪ੍ਰਸਿੱਧ ਮੁੱਖ ਪਕਵਾਨ ਹੈ ਇਸ ਵਿੱਚ ਸਮੱਗਰੀ ਸਾਗ ਦੀ ਸਰੋਂ ਦਾ ਸਾਗ ਮੱਕੀ ਪਾਲਕ ਬਾਥੂ ਹਰੀਆਂ ਮਿਰਚਾਂ ਲਸਣ ਅਦਰਕ ਥੋੜ੍ਹਾ ਮੱਕੀ ਦਾ ਅੱਲਣ ਤੜਕੇ ਲਈ ਪਿਆਜ਼ ਟਮਾਟਰ ਮੱਖਣ ਵਿੱਚ ਵਰਤਿਆ ਜਾਂਦਾ ਹੈ ਸਭ ਤੋਂ ਪਹਿਲਾਂ ਚੁੱਲਾ ਲੱਕੜਾਂ ਬਾਲ ਕੇ ਫਿਰ ਮਿੱਟੀ ਦੀ ਹਾਂਡੀ ਨੂੰ ਧੋ ਕੇ ਚੁੱਲੇ 'ਤੇ ਧਰ ਦਿੱਤਾ ਜਾਂਦਾ ਹੈ ਫਿਰ ਸਾਗ ਨੂੰ ਸਾਫ਼ ਕਰਕੇ ਗੰਦਲਾਂ ਅਲੱਗ ਛਿਲ ਲਈਆਂ ਜਾਂਦੀਆਂ ਹਨ ਸਾਡਾ ਸਾਗ ਧੋ ਕੇ ਕੱਟ ਕੇ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਮਿੱਟੀ ਦੀ ਹਾਂਡੀ ਵਿੱਚ ਸਾਰੀ ਸਮੱਗਰੀ ਪਾ ਦਿੱਤੀ ਜਾਂਦੀ ਹੈ ਫਿਰ ਪੰਜ ਛੇ ਘੰਟੇ ਲਈ ਉਸ ਨੂੰ ਰਿੱਝਣ ਦਿੱਤਾ ਜਾਂਦਾ ਹੈ ਸਾਗ ਦੇ ਵਿੱਚ ਪਾਣੀ ਪਾ ਕੇ ਉਸਨੂੰ ਰਿੱਝਣ ਲਈ ਛੱਡ ਦਿੱਤਾ ਜਾਂਦਾ ਹੈ ਫਿਰ ਘੋਟਣੇ ਨਾਲ ਅੱਲਣ ਪਾ ਕੇ ਸਾਗ ਨੂੰ ਘੋਟਿਆ ਜਾਂਦਾ ਹੈ ਫਿਰ ਤੜਕਾ ਲਗਾਉਣ ਲਈ ਦੇਸੀ ਘਿਓ ਪਾ ਕੇ ਅਦਰਕ ਲਸਣ ਪਿਆਜ ਟਮਾਟਰ ਹਰੀ ਮਿਰਚ ਪਾ ਕੇ ਭੁੰਨ ਲਈਦਾ ਹੈ ਫਿਰ ਉਸ ਵਿੱਚ ਘੋਟਿਆ ਹੋਇਆ ਸਾਗ ਪਾ ਦਿਓ ਫਿਰ ਸਾਗ ਨੂੰ ਪੰਜ ਤੋਂ ਦਸ ਮਿੰਟ ਰਿੱਝਣ ਵਾਸਤੇ ਛੱਡ ਦਿਓ ਜਦੋਂ ਚੰਗੀ ਤਰ੍ਹਾਂ ਸਾਗ ਰਿੱਝ ਜਾਵੇ ਤਾਂ ਸਾਗ ਤਿਆਰ ਹੈ ਇਹ ਸਾਡੇ ਬਹੁਤ ਹੀ ਪੋਸ਼ਟਿਕ ਸਾਡੇ ਸਰੀਰ ਲਈ ਅਤੇ ਸਾਡੇ ਸੱਭਿਆਚਾਰਕ ਲਈ ਪੋਸ਼ਟਿਕ ਭੋਜਨ ਹੈ ਇਹ ਸਰਦੀਆਂ ਵਿੱਚ ਹੀ ਸਾਨੂੰ ਮੁੱਖ ਭੋਜਨ ਮਿਲਦਾ ਹੈ ਸਾਗ ਦੇ ਨਾਲ ਨਾਲ ਖਾਣ ਲਈ ਮੱਕੀ ਦੀ ਰੋਟੀ ਵੀ ਤਿਆਰ ਕੀਤੀ ਜਾਂਦੀ ਹੈ ਫਿਰ ਮੱਕੀ ਦੀ ਰੋਟੀ ਬਣਾਉਣ ਲਈ ਸਾਨੂੰ ਮੱਕੀ ਦਾ ਆਟਾ ਲੈਣਾ ਪੈਂਦਾ ਹੈ ਉਸ ਨੂੰ ਗਰਮ ਪਾਣੀ ਵੀ ਨਾਲ ਗੁੰਨ ਲਿੱਤਾ ਜਾਂਦਾ ਹੈ ਗੁੰਨਣ ਤੋਂ ਬਾਅਦ ਉਸਦੇ ਪੇੜੇ ਬਣਾ ਕੇ ਉਸ ਨੂੰ ਹੱਥਾਂ ਦੇ ਨਾਲ ਥਪ ਥਪਾ ਕੇ ਰੋਟੀ ਵਾਂਗੂ ਤਿਆਰ ਕਰ ਲਿੱਤਾ ਜਾਂਦਾ ਹੈ ਅਤੇ ਗਰਮ ਗਰਮ ਤਵੇ 'ਤੇ ਪਾ ਦੇਣਾ ਹੁੰਦਾ ਹੈ ਅਤੇ ਦੇਸੀ ਘਿਓ ਦੇ ਨਾਲ ਦੋਨੋਂ ਪਾਸੇ ਲਗਾ ਕੇ ਸੇਕ ਲੈਣਾ ਹੈ ਇਸ ਨੂੰ ਵਧੀਆ ਤਰੀਕੇ ਸੇਕਣ ਤੋਂ ਬਾਅਦ ਮੱਕੀ ਦੀ ਰੋਟੀ ਤਿਆਰ ਹੈ ਅਤੇ ਸਾਗ ਦੇ ਨਾਲ ਮੱਕੀ ਦੀ ਰੋਟੀ ਦੇ ਵਿੱਚ ਸਰੋਂ ਦੇ ਸਾਗ ਦੇ ਵਿੱਚ ਦੇਸੀ ਘਿਓ ਪਾ ਕੇ ਸਾਗ ਅਤੇ ਮੱਕੀ ਦੀ ਰੋਟੀ ਸਾਡੇ ਪੰਜਾਬ ਦਾ ਇਤਿਹਾਸਿਕ ਭੋਜਨ ਹੈ